ਹਾਂ ਮੈਂ ਸ਼ੇਅਰ ਮਾਰਕੀਟ ਬਾਰੇ ਜਾਣਦਾ ਹਾਂ ਅਤੇ ਇਸ ਦੇ ਉਤਰਾਅ ਚੜਾਅ ਵੀ ਬਹੁਤ ਜ਼ਿਆਦਾ ਹਨ ਜਿਵੇਂ ਕਿ ਅੱਜ ਕੱਲ੍ਹ ਟਰੈਂਡਿੰਗ ਸ਼ੇਅਰ ਚੱਲ ਰਹੇ ਹਨ ਜ਼ਮੈਟੋ ਸਵੀਗੀ ਰਿਲਾਇਸ ਪਾਵਰ ਜਿਹਨਾਂ ਵਿੱਚ ਕਈ ਵਾਰ ਤਾਂ ਬਹੁਤ ਜ਼ਿਆਦਾ ਚੜਾਅ ਹੁੰਦਾ ਹੈ ਅਤੇ ਇਹ ਆਪਣੇ ਕਸਟਮਰਾਂ ਨੂੰ ਬਹੁਤ ਜ਼ਿਆਦਾ ਮੁਨਾਫਾ ਵੀ ਕਮਾ ਕੇ ਦਿੰਦੇ ਹਨ ਪਰ ਕਈ ਵਾਰੀ ਇਹ ਜਿਹੀ ਸਥਿਤੀ ਆ ਜਾਂਦੀ ਹੈ ਕਿ ਵੱਧਦੇ ਵੱਧਦੇ ਇੱਕਦਮ ਇਹ ਗਿਰਾਵਟ ਵਿੱਚ ਆ ਜਾਂਦੇ ਹਨ ਸ਼ੇਅਰ ਮਾਰਕੀਟ ਕਰਨ ਲਈ ਸਾਨੂੰ ਬਹੁਤ ਹੀ ਜ਼ਿਆਦਾ ਸੰਯਮ ਰੱਖਣਾ ਚਾਹੀਦਾ ਹੈ ਅਤੇ ਬਹੁਤ ਹੀ ਸੂਝ ਬੂਝ ਨਾਲ ਪੈਸਾ ਲਾਉਣਾ ਚਾਹੀਦਾ ਹੈ ਅਤੇ ਜਿਹੜੀ ਡਿਜੀਟਲ ਐਪਾਂ ਅੱਜ ਕੱਲ੍ਹ ਚੱਲ ਰਹੀਆਂ ਹਨ ਜਿਹਨਾਂ ਨਾਲ ਡਿਜੀਟਲ ਔਨਲਾਈਨ ਟ੍ਰਾਂਜੈਕਸ਼ਨ ਕਰਨ ਵਿੱਚ ਬਹੁਤ ਹੀ ਜ਼ਿਆਦਾ ਆਸਾਨੀ ਹੁੰਦੀ ਹੈ ਜਿਸ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਸਹੂਲਤ ਹੋ ਗਈ ਹੈ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪੈਸੇ ਭੇਜਣ ਵਿੱਚ ਬਹੁਤ ਜ਼ਿਆਦਾ ਆਸਾਨੀ ਹੁੰਦੀ ਹੈ ਅਤੇ ਇਹ ਬਹੁਤ ਜ਼ਿਆਦਾ ਸੁਰੱਖਿਅਤ ਵੀ ਹਨ ਪਰ ਕਿਸੀ ਕਿਸੀ ਜਗ੍ਹਾ ਇਹ ਬਹੁਤ ਜ਼ਿਆਦਾ ਖਤਰਨਾਕ ਵੀ ਸਾਬਿਤ ਹੁੰਦੇ ਹਨ ਜਿੱਥੇ ਲੋਕਾਂ ਨੂੰ ਇੰਨੀ ਸੂਝ ਨਹੀਂ ਹੁੰਦੀ ਉਹ ਆਪਣਾ ਓ ਟੀ ਪੀ ਵਗੈਰਾ ਸ਼ੇਅਰ ਕਰ ਦਿੰਦੇ ਹਨ ਜਿਸ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਅਤੇ ਉਹਨਾਂ ਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ